ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਮੈਂ ਤੁਹਾਡੇ ਰੈਸਟੋਰੈਂਟ ਤੋਂ ਜੋ ਵੀ ਪਹਿਲਾਂ ਸਮਾਨ ਮੰਗਵਾਉਂਦਾ ਸੀਗਾ ਪਹਿਲਾਂ ਮੈਂ ਸੋਹਾਣੇ ਵਿੱਚ ਰਹਿੰਦਾ ਸੀ ਪ੍ਰੰਤੂ ਹੁਣ ਮੈਂ ਜਿਹੜਾ ਆਪਣਾ ਹੈਗਾ ਹੈ ਘਰ ਜਿਹੜਾ ਹੈਗਾ ਹੈ ਚੇਂਜ ਕਰ ਲਿਆ ਹੈ ਹੁਣ ਮੈਂ ਦੋ ਸੌ ਤ੍ਰੇਹਠ ਸੈਕਟਰ ਅਠੱਤਰ ਮੋਹਾਲੀ ਵਿੱਚ ਰਹਿ ਰਿਹਾ ਹਾਂ ਹੁਣ ਜਿਹੜਾ ਵੀ ਮੇਰੇ ਵੱਲੋਂ ਔਡਰ ਦਿੱਤਾ ਜਾਇਆ ਕਰੇਗਾ ਉਸ ਦੇ ਵਿੱਚ ਮੇਰੇ ਇਸ ਪਤੇ 'ਤੇ ਹੀ ਮੈਨੂੰ ਭੇਜਿਆ ਜਾਵੇ ਥੈਂਕ ਯੂ